ਦੋ ਅਕਤੂਬਰ ਦੋ ਹਜ਼ਾਰ ਚੌਦਾਂ ਸਤਾਰਾਂ ਜੁਲਾਈ ਦੋ ਹਜ਼ਾਰ ਤੇਰਾਂ ਛੇ ਜੂਨ ਉੱਨੀ ਸੌ ਚੁਰਾਸੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਦੋ ਹਜ਼ਾਰ ਚੌਦਾਂ